ਕਿਸੇ ਵੀ ਸਮਾਜ ਦੇ ਵਿੱਚ ਜਿੰਨੀ ਭੂਮਿਕਾ ਇੱਕ ਔਰਤ ਦੀ ਹੈ ਓਨੀ ਭੂਮਿਕਾ ਹੀ ਵੀ ਇੱਕ ਮਰਦ ਦੀ ਹੈ ਉਸ ਤਰ੍ਹਾਂ ਪੂਰੇ ਪਰਿ ਇੱਕ ਪਰਿਵਾਰ ਦੇ ਵਿੱਚ ਵੀ ਦੋਨਾਂ ਧਿਰਾਂ ਦੀ ਪੂਰੀ ਜ਼ਰੂਰਤ ਹੈ ਕਿਉਂਕਿ ਜਿਵੇਂ ਇੱਕ ਮਨੁੱਖ ਇੱਕ ਲੱਤ ਦੇ ਉੱਤੇ ਨਹੀਂ ਤੁਰ ਸਕਦਾ ਉਸ ਤਰ੍ਹਾਂ ਇੱਕ ਪਰਿਵਾਰ ਵੀ ਕਿਸੇ ਇੱਕ ਔਰਤ ਜਾਂ ਕਿਸੇ ਇੱਕ ਮਰਦ ਦੇ ਨਾਲ ਨਹੀਂ ਚੱਲ ਸਕਦਾ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਕਰਨ ਲਈ ਇੱਕ ਔਰਤ ਦੀ ਜ਼ਰੂਰਤ ਪੈਂਦੀ ਹੀ ਹੈ ਅਤੇ ਕੁਝ ਅਜਿਹੇ ਕੰਮ ਵੀ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਲਈ ਇੱਕ ਮਰਦ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਕੰਮ ਇਸ ਪ੍ਰਕਾਰ ਵੰਡੇ ਹੁੰਦੇ ਹਨ ਜਿਵੇਂ ਮਰਦ ਸਰੀਰਕ ਬਲ ਦੇ ਵਿੱਚ ਤਾਕਤਵਰ ਹੁੰਦੇ ਹਨ ਤਾਂ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਹਿੱਸੇ ਅਜਿਹੇ ਕੰਮ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਸਰੀਰਕ ਬਲ ਦੀ ਲੋੜ ਹੁੰਦੀ ਹੈ ਉਸ ਤਰ੍ਹਾਂ ਜਿਨ੍ਹਾਂ ਕੰਮਾਂ ਦੇ ਵਿੱਚ ਸਰੀਰਕ ਬਲ ਦੀ ਲੋੜ ਨਹੀਂ ਹੁੰਦੀ ਉਹਨਾਂ ਕੰਮਾਂ ਨੂੰ ਜ਼ਿਆਦਾਤਰ ਔਰਤਾਂ ਕਰਦੀਆਂ ਹਨ ਅਤੇ ਜਿਵੇਂ ਕਿ ਭਾਵਨਾਵਾਂ ਦੇ ਰੂਪ ਦੇ ਵਿੱਚ ਔਰਤਾਂ ਜ਼ਿਆਦਾ ਥੋੜ੍ਹੀਆਂ ਥੋੜ੍ਹੀਆਂ ਜ਼ਿਆਦਾ ਮ ਰੂਪ ਜ਼ਿਆਦਾ ਜਿਵੇਂ ਭਾਵਨਾਵਾਂ ਦੇ ਰੂਪ ਦੇ ਵਿੱਚ ਔਰਤਾਂ ਥੋੜ੍ਹੀਆਂ ਜ਼ਿਆਦਾ ਭਾਵੁਕ ਹੁੰਦੀਆਂ ਹਨ ਤਾਂ ਇਸ ਕਰਕੇ ਬੱਚਾ ਵਗੈਰਾ ਨੂੰ ਸਾਂਭਣਾ ਬੱਚਿਆਂ ਨੂੰ ਸਾਂਭਣਾ ਉਹਨਾਂ ਦੇ ਹਿੱਸੇ ਆਉਂਦਾ ਹੈ